ਪੁਰਾਣੇ ਸਮੇਂ ਵਿੱਚ ਜਿਹੜੇ ਸਾਡੇ ਨੇਤਾ ਸੀ ਉਹਨਾਂ ਵੱਲੋਂ ਸਾਡੇ ਸਰ ਜਿਹੜੇ ਆ ਸ ਸਮਾਜਾਂ ਨੂੰ ਸੁਧਾਰਨ ਲਈ ਬਹੁਤ ਸਾਰੇ ਤਰੀਕੇ ਆਪਣਾਈ ਦੇ ਹੁੰਦੇ ਸੀਗੇ ਹੁਣ ਦੇ ਸ ਜਿਹੜੇ ਨੇਤਾ ਨੇ ਉਹ ਵੀ ਬਹੁਤ ਸਾਰੇ ਤਰੀਕੇ ਅਪਣਾਉਂਦੇ ਨੇ ਸਾਡੇ ਜਿਵੇਂ ਸਮਾਜ ਨੂੰ ਸੁਧਾਰਨ ਲਈ ਸਿੱਖਿਆ ਦੇ ਪ੍ਰਬੰਧ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਲਿਆਉਂਦੇ ਨੇ ਹੈ ਨਾ ਸਿਹਤ ਸੰਭਾਲ ਨੂੰ ਲੈ ਕੇ ਆਵਾਜਾਈ ਦੇ ਸਾਧਨਾਂ ਨੂੰ ਲੈ ਕੇ ਠੀਕ ਹੈ ਅਤੇ ਤਕਨੋਲਜੀ ਜਿਹੜੀ ਹੈ ਉਹ ਅੱਜ ਕੱਲ੍ਹ ਬਹੁਤ ਵਧੀਆ ਏ ਹ ਹੋਰ ਵਧੀਆ ਅੱਗੇ ਤੋਂ ਅੱਗੇ ਵਧੀਆ ਹੋਈ ਜਾਂਦੀ ਆ ਵਪਾਰ ਦੀ ਗੱਲ ਕਰੀਏ ਤਾਂ ਜਿਹੜਾ ਸਾਡਾ ਵਪਾਰ ਹੈ ਪਹਿਲਾਂ ਬਹੁਤ ਘੱਟ ਦੇਸ਼ਾਂ 'ਚ ਜਾਂਦਾ ਸੀ ਹੁਣ ਹਰ ਕਿਤੇ ਹੀ ਜਾਂਦਾ ਆ ਜਿਹੜਾ ਇੱਕ ਅਸੀਂ ਇੱਕ ਤੋਂ ਦੂਸਰੇ ਦੇਸ਼ ਤੱਕ ਵਪਾਰ ਕਰਨਾ ਸਾਡਾ ਸੌਖਾ ਹੋ ਗਿਆ ਹੈ ਅੱਜ ਕੱਲ੍ਹ ਦੀ ਤਕਨੋਲਜੀ ਜਿਹੜੀ ਆ ਇੰਨੀ ਵਧੀਆ ਹੋ ਗਈ ਹੈ ਕਿ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਜਿਹੜਾ ਕੁਛ ਵੀ ਭੇਜਣਾ ਭੇਜਾ ਭੇਜ ਸਕਦੇ ਹਾਂ ਹੈ ਨਾ ਸਰਕਾਰ ਵੱਲੋਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਉਹਨਾਂ ਵਿੱਚ ਬਦਲਾਅ ਲਿਆਇਆ ਗਿਆ ਹੈ ਸੜਕਾਂ ਬਣਾਈਆਂ ਗਈਆਂ ਨੇ ਬਹੁਤ ਕੁਛ ਕੀਤਾ ਗਿਆ ਸਾਡੇ ਸਮਾਜ ਨੂੰ ਸੁਧਾਰਨ ਲਈ ਜਿਹਨਾਂ ਸ ਲੋਕਾਂ ਨੂੰ ਵੀ ਵਧੀਆ ਲੱਗਦਾ ਅਤੇ ਲੋਕਾਂ ਦੀ ਜਿਹੜੀ ਡੇਲੀ ਜਿਹੜੀ ਰੂਟੀਨ ਆ ਉਹਦੇ 'ਚ ਤਬਦੀਲੀ ਆਉਂਦੀ ਹੈ ਅਤੇ ਸਰਕਾਰ ਵੱਲੋਂ ਨੌਕਰੀਆਂ ਦਿੱਤੀਆਂ ਜਾਂਦੀਆਂ ਏ ਬੱਚਿਆਂ ਨੂੰ ਕਿ ਜਿਹੜੇ ਉਹ ਆਪਣੇ ਆਪ ਰੁਜ਼ਗਾਰ ਕਰਨ ਅਤੇ ਆਪਣੇ ਘਰ ਨੂੰ ਚਲਾ ਸਕਣ